ਮੈਂ ਓਲਾ ਬੁੱਕ ਕੀਤੀ ਸੀ ਮੈਂ ਤਰਨ ਤਾਰਨ ਤੋਂ ਹਵਾਈ ਅੱਡੇ ਜਾਣਾ ਸੀ ਪ੍ਰੰਤੂ ਹੁਣ ਮੇਰੀ ਤੁਸੀਂ ਬੁਕਿੰਗ ਰੱਦ ਕਰ ਦਿਓ ਕਿਉਂਕਿ ਹੁਣ ਮੈਂ ਹਵਾਈ ਅੱਡੇ ਦੀ ਥਾਂ ਗੋਬਿੰਦਗੜ੍ਹ ਫੋਟ ਜਾਣਾ ਹੈ ਡਰਾਈਵਰ ਦਸ ਵੱਜ ਕੇ ਉਨੱਤੀ ਮਿੰਟ 'ਤੇ ਪਹੁੰਚ ਜਾਵੇ ਲੇਟ ਨਾ ਆਵੇ ਸਮੇਂ ਸਿਰ ਆ ਜਾਵੇ ਕਿਰਪਾ ਕਰਕੇ ਮੇਰੀ ਪਹਿਲੇ ਵਾਲੀ ਬੁਕਿੰਗ ਰੱਦ ਕਰ ਦਿਓ ਧੰਨਵਾਦ